ਕਈ ਸਾਲ ਲਗਾਤਾਰ ਕੰਮ ਕਰਨ ਤੋਂ ਬਾਅਦ ਮੈਂ ਅਤੇ ਮੇਰੇ ਦੋਸਤਾਂ ਨੇ ਇਹ ਸੋਚਿਆ ਸੀ ਕੀ ਅਸੀਂ ਕੰਮ ਤੋਂ ਕੁੱਝ ਸਮੇਂ ਲਈ ਛੁੱਟੀਆਂ ਲਵਾਂਗੇ ਅਤੇ ਅਸੀਂ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਪਹਾੜਾਂ ਵਿੱਚ ਘੁੰਮਣ ਜਾਵਾਂਗੇ ਜਿੱਥੇ ਅਸੀਂ ਇੰਟਰਨੈਟ ਦੀ ਵਰਤੋਂ ਨਹੀਂ ਕਰਾਂਗੇ ਅਤੇ ਅਸੀਂ ਯੋਗਾ ਕਰਾਂਗੇ ਜਿਸ ਨਾਲ ਸਾਡੀ ਸਿਹਤ ਅਤੇ ਸਾਡੇ ਦਿਮਾਗ ਉੱਤੇ ਵਧੀਆ ਪ੍ਰਭਾਵ ਪਵੇਗਾ ਅਤੇ ਅਸੀਂ ਉੱਥੇ ਪੂਰਾ ਆਰਾਮ ਕਰਾਂਗੇ ਤਾਂ ਅਸੀਂ ਇਕ ਤੰਦਰੁਸਤ ਮਹਿਸੂਸ ਕਰ ਸਕਾਂਗੇ ਕਿਉਂਕੀ ਕੰਮ ਦੇ ਇਹ ਲੋੜ ਤੋਂ ਬਾਅਦ ਸਾਨੂੰ ਜਰੂਰਤ ਸੀ ਤਾਂ ਕੀ ਸਾਡਾ ਦਿਮਾਗ ਖਾਲੀ ਰਹਿ ਸਕੇ ਅਤੇ ਸਾਨੂੰ ਆਰਾਮਦਾਇਕ ਛੁੱਟੀਆਂ ਬਤੀਤ ਕਰ ਸਕੀਏ ਤਾਂ ਅਸੀਂ ਹਿਮਾਚਲ ਪ੍ਰਦੇਸ਼ ਪਹਾੜਾਂ ਵਿੱਚ ਗਏ ਉੱਥੇ ਠੰਡਾ ਮੌਸਮ ਸੀ ਜਿਸ ਨਾਲ ਅਸੀਂ ਸਵੇਰੇ ਉੱਠ ਕੇ ਯੋਗਾ ਕਰਦੇ ਸੀ ਅਤੇ ਆਪਣਾ ਇੱਕ ਸਾਦਾ ਜੀਵਨ ਜਿਉਣ 'ਤੇ ਲੱਗ ਗਏ ਸਨ